ਮੈਂ ਆਪਣੇ ਇੱਕ ਦਿਨ ਦੀ ਖੁਰਾਕ ਦੀ ਗੱਲ ਕਰਾਂ ਤਾਂ ਮੈਂ ਅਚ ਅਨ ਰੋਟੀ ਜਿਹੜੀ ਆ ਉਹ ਸਿਰਫ਼ ਇੱਕੋ ਟਾਈਮ ਖਾਂਦੀ ਹਾਂ ਬਾਕੀ ਟਾਈਮ ਫਰੂਟਸ ਅਤੇ ਇੱਕ ਟਾਈਮ ਚਾਵਲ ਜਿਹੜੇ ਉਹ ਖਾਣੇ ਪ੍ਰੈਫਰ ਕਰਦੀ ਹਾਂ ਮੈਂ ਆਪਣੀ ਕਿਉਂਕਿ ਮੈਨੂੰ ਪਤਾ ਕਿ ਜੇ ਆਪਾਂ ਅੱਜ ਸੰਤੁਲਿਤ ਖ਼ੁਰਾਕ ਖਾਵਾਂਗੇ ਤਾਂ ਹੀ ਇਹ ਜਿਹੜੀ ਸਾਡੀ ਬਾਡੀ ਹੈਗੀ ਆ ਉਹ ਚੰਗੀ ਤਰ੍ਹਾਂ ਨਾਲ ਆਪਾਂ ਉਹਨੂੰ ਮੈਨੇਜ ਕਰ ਸਕਦੇ ਹਾਂ ਇਸ ਲਈ ਮੈਂ ਆਪਣੀ ਫਰੂ ਡਾਇਟ ਦੇ ਵਿੱਚ ਫਰੂਟਸ ਵੈਜੀਟੇਬਲਸ ਜ਼ਰੂਰ ਐਡ ਕਰਦੀ ਹਾਂ ਜਿਵੇਂ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਸਰਦੀ ਦਾ ਮੌਸਮ ਚੱਲ ਰਿਹਾ ਅਤੇ ਧੁੱਪ ਵੀ ਹੈ ਅਤੇ ਮੈਂ ਦੋ ਸੰਤਰੇ ਦੋ ਤਿੰਨ ਸੰਤਰੇ ਖਾਣੇ ਜਿਹੜੇ ਆ ਉਹ ਮਤਲਬ ਨੋਰਮਲੀ ਖਾ ਲੈਂਦੀ ਹਾਂ ਕਿਉਂਕਿ ਉਹਦੇ ਨਾਲ ਇੱਕ ਤਾਂ ਵਿਟਾਮਿਨ ਸੀ ਮਿਲਦਾ ਅਤੇ ਉੱਤੋਂ ਉਹਨਾਂ ਨੂੰ ਮਤਲਬ ਹੈਲਥ ਬੈਨੀਫਿਟਸ ਵੀ ਕਾਫ਼ੀ ਹੁੰਦੇ ਨੇ ਉਹਦੇ ਮੈਂ ਆਪਣੀ ਜਦੋਂ ਮੈਂ ਆਪਣੀ ਮਤਲਬ ਮੋਰਨਿੰਗ ਦੀ ਮੀਲ ਲੈਂਦੀ ਹਾਂ ਉਹਦੇ ਵਿੱਚ ਮੈਂ ਜਿਹੜੇ ਨੇ ਉਹ ਨਟਸ ਵਗੈਰਾ ਬਦਾਮ ਠੀਕ ਹੈ ਬਦਾਮ ਭਿੱਜੇ ਹੋਏ ਬਦਾਮ ਠੀਕ ਹੈ ਸਾਰੇ ਲੈਣਾ ਪਸੰਦ ਕਰਦੀ ਹਾਂ ਅਤੇ ਰਾਤ ਦੇ ਫੂਡ ਦੇ ਵਿੱਚ ਜੇ ਮੈਂ ਰਾਤ ਦੇ ਖਾਣੇ ਦੀ ਗੱਲ ਕਰਾਂ ਤਾਂ ਰਾਤ ਦੇ ਖਾਣੇ 'ਚ ਮੈਂ ਮੋਸਟਲੀ ਸੈਲਿਡ ਹੀ ਖਾਂਦੀ ਹਾਂ ਜਿਵੇਂ ਟਮੈਟੋਸ ਸੈਲਿਡ ਹੋ ਗਿਆ ਜਾਂ ਖੀਰਾ ਪਾ ਦਿੱਤਾ ਉਹਦੇ 'ਚ ਗਾਜਰ ਪਾ ਦਿੱਤੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਉਹ ਐਡ ਕਰਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਸਬਜ਼ੀਆਂ ਚੌਲ ਅਤੇ ਉਹਨਾਂ ਦੀ ਕੁਆਲਿਟੀ ਯਾਨੀ ਆਹ ਜਿਹੜਾ ਮੈਂ ਫੂਡ ਖਾ ਰਹੀ ਆ ਉਹਦੀ ਕੁਆਲਿਟੀ ਮੈਨੂੰ ਉਹ ਠੀਕ ਲੱਗਦੀਆਂ ਹਾਂ ਅੱਜ ਕੱਲ੍ਹ ਮਿਲਾਵਟ ਤਾਂ ਹਰ ਚੀਜ਼ 'ਚ ਹੈਗੀ ਆ ਲੇਕਿਨ ਮੈਨੂੰ ਫਿਰ ਵੀ ਲੱਗਦਾ ਕਿ ਬਾਕੀ ਏਰੀਆਸ ਵਿੱਚ ਜਿਵੇਂ ਮੈਂ ਜੇ ਆਪਣੀ ਆਪਣੇ ਏਰੀਏ ਦੀ ਗੱਲ ਚੰਡੀਗੜ੍ਹ ਨਾਲ ਕੰਪੇਅਰ ਕਰਾਂ ਤਾਂ ਉੱਥੇ ਨਾਲੋਂ ਮਤਲਬ ਸਾਡੇ ਪਿੰਡਾਂ ਵਿੱਚ ਜਿਹੜਾ ਉਹ ਖ਼ੁਰਾਕ ਜਿਹੜੀ ਆ ਉਹਨਾਂ ਨਾਲੋਂ ਵਧੀਆ ਮਿਲ ਰਹੀ ਹੈ ਕਿਉਂਕਿ ਅਸੀਂ ਫਰੈੱਸ਼ ਜਿਹੜੀ ਆ ਉਹਨੂੰ ਤੋੜ ਕੇ ਵੀ ਲਿਆ ਸਕਦੇ ਈਵਨ ਸਾਡੇ ਅ ਕੋਲ ਜਿਹੜੀਆਂ ਏਰੀਆਜ ਹੁੰਦੇ ਨੇ ਉਹਨਾਂ ਵਿੱਚ ਵੀ ਆਪਾਂ ਉਗਾਈ ਹੁੰਦੀ ਆ ਆਪਾਂ ਉੱਥੋਂ ਵੀ ਆਪਣੀ ਵੀ ਤੋੜ ਕੇ ਜਿਹੜੀ ਉਹ ਬਣਾ ਲੈਂਦੇ ਹਾਂ ਅਤੇ ਮੈਨੂੰ ਲੱਗਦਾ ਕਿ ਦੂਸਰੇ ਸ਼ਹਿਰਾਂ ਨਾਲੋਂ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਆ ਖ਼ੁਰਾਕ ਜਿਹੜੀ ਆ ਉਹ ਜ਼ਿਆਦਾ ਵਧੀਆ ਮਿਲਦੀ ਹੈ